ਪਰਿਵਾਰ ਦੇ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਦਾ ਹੋਣਾ ਜ਼ਰੂਰੀ ਹੈ ਔਰਤ ਹੈ ਜਿਹੜੀ ਉਹ ਆਪਣੇ ਘਰ ਦੇ ਵਿੱਚ ਜਿਵੇਂ ਖਾਣਾ ਪਕਾਉਣਾ ਕੱਪੜੇ ਧੋਣੇ ਸਾਫ਼ ਸਫ਼ਾਈ ਕਰਨਾ ਇਹ ਉਹਦੇ ਕੰਮ ਨੇ ਬੱਚਿਆਂ ਨੂੰ ਸਾਂਭਣਾ ਅਤੇ ਮਰਦ ਹੈ ਜਿਹੜਾ ਉਹ ਬਾਹਰ ਖੇਤੀਬਾੜੀ ਦਾ ਕੰਮ ਮਜ਼ਦੂਰੀ ਦਾ ਕੰਮ ਪੈਸੇ ਕਮਾਉਣਾ ਜਿਹੜਾ ਉਹਦਾ ਮੇਨ ਉਹ ਕੰਮ ਹੁੰਦਾ ਪਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਵੈਸਟਰਨ ਕਲਚਰ ਦੇ ਕਰਕੇ ਜਿਹੜਾ ਔਰਤ ਅਤੇ ਮਰਦ ਹੈ ਜਿਹੜੇ ਉਹ ਬਰਾਬਰ ਹੈ ਔਰਤਾਂ ਵੀ ਬਾਹਰ ਜਾ ਕੇ ਜਿਹੜਾ ਕੰਮ ਕਰਦੀਆਂ ਪੈਸੇ ਕਮਾਉਂਦੀਆਂ ਮਰਦ ਘਰ ਦੇ ਵਿੱਚ ਖਾਣਾ ਬਣਾਉਂਦਾ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਔਰਤਾਂ ਅਤੇ ਮਰਦਾਂ ਦੇ ਕੰਮ ਆ ਜਿਹੜੇ ਉਹ ਸੇਮ ਸੇਮ ਹੋਏ ਪਏ ਨੇ ਕੋਈ ਬਹੁਤਾ ਫ਼ਰਕ ਨਹੀਂ ਹੈਗਾ ਪਰ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਔਰਤਾਂ ਜਿਹੜੀਆਂ ਉਹ ਘਰ 'ਚ ਹੀ ਰਹਿੰਦੀਆਂ ਸੀ ਘਰ ਦੇ ਕੰਮ ਕਰਦੀਆਂ ਸੀ ਮਰਦ ਹੈ ਜਿਹੜੇ ਉਹ ਬਾਹਰ ਕੰਮ ਕਰਦੇ ਸੀ ਜਿਹੜਾ ਮੇਨ ਕੰਮ ਖੇਤੀਬਾੜੀ ਦਾ ਹੋ ਗਿਆ ਮਜ਼ਦੂਰੀ ਹੋ ਗਈ ਹੋਰ ਜਿਹੜੇ ਕੰਮ ਹੁੰਦੇ ਸੀ ਉਹਨਾਂ ਨੇ ਪੈਸਾ ਕਮਾਉਣਾ ਜਿਹੜਾ ਮੇਨ ਮਰਦਾਂ ਦਾ ਕੰਮ ਹੁੰਦਾ ਸੀ